ਹਾਂਜੀ ਤੁਸੀਂ ਓਲਾ ਵਾਲਿਆਂ ਤੋਂ ਬੋਲ ਰਹੇ ਹੋ ਤੁਹਾਡੀ ਮੈਂ ਗੱਡੀ ਬੁੱਕ ਕਰਵਾਈ ਸੀ ਉਹ ਦੀਆਂ ਸੀਟਾਂ ਵੀ ਫਟੀਆਂ ਹੋਈਆਂ ਸੀ ਅਤੇ ਪੈਂਚਰ ਵੀ ਹੋਇਆ ਹੋਇਆ ਸੀ ਅਤੇ ਬਹੁਤ ਸਾਰੀਆਂ ਦਿੱਕਤਾਂ ਆ ਰਹੀ ਸੀ ਜਿੱਥੇ ਮੈਂ ਜਾਣਾ ਸੀ ਉੱਥੇ ਨਹੀਂ ਪਹੁੰਚ ਪਾਈ ਅਤੇ ਇਸ ਕਰਕੇ ਮੈਂ ਆਪਣੀ ਸ਼ਿਕਾਇਤ ਦਰਜ ਕਰਵਾ ਰਹੀ ਹਾਂ